ਜੇਕਰ ਨੌਜ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਘੱਟ ਸੱਭਿਆਚਾਰਕ ਰੀਤਾਂ ਰਿਵਾਜ਼ਾਂ ਨੂੰ ਮੰਨਦੇ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਵੈਸਟਨ ਕਲਚਰ ਨੂੰ ਅਡੋਪਟ ਕਰਨਾ ਉਹਨਾਂ ਨੇ ਸਟਾਰਟ ਕਰ ਦਿੱਤਾ ਕਿਉਂਕਿ ਵੈਲ ਐਜੂਕੇਟਡ ਹੋ ਗਏ ਅਤੇ ਜਦੋਂ ਉਹ ਬਿਜਨਸ ਕਰਦੇ ਨੇ ਜਾਂ ਹੈ ਨਾ ਫੋਰਨ ਦੇ ਲੋਕਾਂ ਨਾਲ ਮਿਲਦੇ ਨੇ ਜਾਂ ਵੱਡੇ ਵੱਡੇ ਸ਼ਹਿਰਾਂ ਚ ਜਾਂਦੇ ਨੇ ਤਾਂ ਉਹ ਵੈਸਟਰਨ ਕਲਚਰ ਹੀ ਫੋਲੋ ਕਰਦੇ ਨੇ ਤਾਂ ਉਹ ਬਹੁਤ ਘੱਟ ਮਤਲਬ ਆਪਣਾ ਭਾਰਤੀ ਪਹਿਰਾਵੇ ਨੂੰ ਪ੍ਰਮੋਟ ਕਰਦੇ ਨੇ ਜਾਂ ਹੈ ਨਾ ਸਿਰਫ ਸਾਡਾ ਜਿਹੜਾ ਕਲਚਰ ਆ ਜਾਂ ਸਾਡਾ ਪਹਿਰਾਵਾ ਜਿਹੜੇ ਸਾਡੇ ਰੀਤਾਂ ਰਿਵਾਜ਼ਾਂ ਉਹ ਸਿਰਫ ਸ਼ਾਇਦ ਇੱਕ ਤਿਉਹਾਰ ਦੇ ਰੂਪ ਵਿੱਚ ਹੀ ਰਹਿ ਗਈਆਂ ਜਦੋਂ ਦਿਵਾਲੀ ਹੋਇਆ ਤਾਂ ਅਸੀਂ ਆਪਣੇ ਪਹਿਰਾਵੇ ਨੂੰ ਫੋਲੋ ਕਰਦੇ ਹਾਂ ਜਾਂ ਫਿਰ ਹੈ ਨਾ ਵਿਆਹ ਹੋਇਆ ਤਾਂ ਅਸੀਂ ਉਸ ਚੀਜ਼ ਨੂੰ ਪਰ ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਵਿਆਹਾਂ ਵਿੱਚ ਵੀ ਉਹ ਚੀਜ਼ ਨਹੀਂ ਰਹੀ ਹੈਗੀ ਜਿਹੜੀ ਪਹਿਲਾਂ ਹੁੰਦੀ ਸੀਗੀ ਪਹਿਲਾਂ ਇੱਕ ਇੱਕ ਹਫਤੇ ਪਹਿਲਾਂ ਹੈ ਨਾ ਜਿਹੜੀਆਂ ਘਰ ਦੇ ਬਜ਼ੁਰਗ ਹੁੰਦੇ ਸੀਗੇ ਹੈ ਨਾ ਘਰ ਦੀਆਂ ਔਰਤਾਂ ਹੁੰਦੀਆਂ ਸੀਗੀਆਂ ਤਾਂ ਉਹ ਸੁਹਾਗ ਗਾਉਂਦੀਆਂ ਸੀਗੀਆਂ ਘੋੜੀਆਂ ਗਾਉਂਦੀਆਂ ਸੀਗੀਆਂ ਹੈ ਨਾ ਤਾਂ ਅੱਜ ਕੱਲ੍ਹ ਉਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਆ ਉਹ ਇਸ ਚੀਜ਼ਾਂ ਨੂੰ ਸਾਡੀਆਂ ਜਿਹੜੀਆਂ ਸੱਭਿਆਚਾਰਕ ਰੀਤਾਂ ਰਿਵਾਜ਼ਾਂ ਇਹਨਾਂ ਸੰਸਕ੍ਰਿਤੀਆਂ ਨੂੰ ਭੁੱਲਦੀ ਜਾ ਰਹੀ ਆ ਤਾਂ ਆਪਾਂ ਨੂੰ ਉਹ ਜਿਹੜੀ ਸਾਡੀਆਂ ਸਰਕਾਰਾਂ ਨੇ ਜਾਂ ਹੈ ਨਾ ਜਿਹੜੇ ਸਾਡੇ ਜਿਹੜੇ ਵੀ ਸਾਡੇ ਟੀਚਰਸ ਨੇ ਜਿਹੜੇ ਸਾਡੇ ਹੈ ਨਾ ਗਾਈਡ ਜਿਵੇਂ ਸਾਨੂੰ ਗਾਈਡ ਕਰਦੇ ਨੇ ਹੈ ਨਾ ਉਹਨਾਂ ਨੂੰ ਚਾਹੀਦਾ ਆ ਕਿ ਨੌਜਵਾਨਾਂ ਨੂੰ ਹੈ ਨਾ ਇਸ 'ਚ ਇਸ ਚੀਜ਼ ਬਾਰੇ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਹੈ ਨਾ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਸਾਡੇ ਸੱਭਿਆਚਾਰਕ ਅਮੀਰ ਵਿਰਸੇ ਨੂੰ ਹੈ ਨਾ ਹਮੇਸ਼ਾਂ ਯਾਦ ਰੱਖ ਸਕਣ ਥੈਂਕ ਯੂ